ਮੈਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੈੱਨ ਨਾਲ ਲਿਖਣਾ ਪਸੰਦ ਆ ਮਤਲਬ ਪੈੱਨ ਨਾਲ ਹੀ ਕਾਗਜ਼ 'ਤੇ ਲਿਖਣਾ ਪਸੰਦ ਆ ਹਾਂ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ ਉਦੋਂ ਮੋਬਾਇਲ ਫੋਨਸ ਨਹੀਂ ਹੁੰਦੇ ਸੀਗੇ ਕਿਉਂਕਿ ਉਦੋਂ ਟੈਕਨੋਲਜੀ ਇੰਨੀ ਜ਼ਿਆਦਾ ਡਿਵੈਲਪ ਨਹੀਂ ਸੀਗੀ ਹੋਈ ਹਾਂ ਉਸ ਤੋਂ ਬਾਅਦ ਜਦੋਂ ਫੋਨਸ ਆ ਗਏ ਇੱਕ ਦੋ ਵਾਰੀ ਮੈਂ ਕੋਸ਼ਿਸ਼ ਕੀਤੀ ਫੋਨ 'ਤੇ ਲਿਖਣ ਦੀ ਕਿ ਮੈਂ ਫੋਨ 'ਤੇ ਲਿਖਣਾ ਸ਼ੁਰੂ ਕਰਾਂ ਜੋ ਵੀ ਮੈਂ ਲਿਖਦੀ ਹਾਂ ਜਿੱਦਾਂ ਕੋਈ ਕਵਿਤਾ ਜਾਂ ਫਿਰ ਮੇਰੀ ਡਾਇਰੀ ਵਗੈਰਾ ਪਰ ਜਦੋਂ ਮੈਂ ਫੋਨ 'ਤੇ ਜਾਂ ਲੈਪਟੋਪ 'ਤੇ ਲਿਖਣ ਦੀ ਕੋਸ਼ਿਸ਼ ਕਰਦੀ ਹਾਂ ਨਾ ਮੈਨੂੰ ਐਂ ਨਹੀਂ ਲੱਗਦਾ ਸੀ ਕਿ ਮੇਰੀਆਂ ਜਿਹੜੀਆਂ ਭਾਵਨਾਵਾਂ ਉਹ ਚੰਗੀ ਤਰਾਂ ਉਹਦੇ ਵਿੱਚ ਦਿਖ ਰਹੀਆਂ ਨੇ ਮੈਨੂੰ ਐਂ ਲੱਗਦਾ ਸੀ ਕਿ ਬਸ ਜਿੱਦਾਂ ਆਪਾਂ ਇੱਕ ਕੋਈ ਅਸਾਈਨਮੈਂਟ ਜਿਹੀ ਬਣਾਉਂਦੇ ਹਾਂ ਉੱਦਾਂ ਉਹ ਚੀਜ਼ ਹੁੰਦੀ ਪਈ ਆ ਜਿਹੜੀ ਮੋਸ਼ਨਸ ਮੈਂ ਸਿੱਧਾ ਪੈੱਨ ਦੇ ਨਾਲ ਕਾਗਜ਼ 'ਤੇ ਉਤਾਰਦੀ ਹਾਂ ਨਾ ਆਪਣੀ ਆਪਣੀਆਂ ਭਾਵਨਾਵਾਂ ਉਹ ਦਿਖਦੀਆਂ ਹੈ ਕਿ ਹਾਂ ਬੰਦੇ ਨੇ ਬੜੀਆਂ ਹੀ ਮਤਲਬ ਆਪਣੇ ਸਾਰੇ ਇਮੋਸ਼ਨਸ ਨਾਲ ਇਹ ਚੀਜ਼ ਲਿਖੀ ਹੋਈ ਆ ਜੋ ਕਿ ਮੈਨੂੰ ਇਹ ਨਹੀਂ ਲੱਗਦਾ ਕਿ ਬੰਦਾ ਆਪਣੀ ਮੋਬਾਈਲ ਫੋਨ 'ਤੇ ਜਾਂ ਲੈਪਟੋਪ 'ਤੇ ਉਹ ਚੀਜ਼ ਕਰ ਸਕਦਾ ਹੈ ਚਲੋ ਬਾਕੀਆਂ ਦਾ ਤਾਂ ਨਹੀਂ ਪਤਾ ਪਰ ਹਾਂ ਮੈਨੂੰ ਇਹ ਚੀਜ਼ ਜ਼ਰੂਰ ਆ ਕਿ ਕਾਗਜ਼ ਪੈੱਨ ਤੋਂ ਪੈੱਨ ਦੇ ਨਾਲ ਜਿਹੜੇ ਮੈਂ ਇਮੋਸ਼ਨ ਲਿਖ ਪਾਉਂਦੀ ਹਾਂ ਉਹ ਮੇਰੇ ਤੋਂ ਮੋਬਾਇਲ ਫੋਨ ਜਾਂ ਲੈਪਟੋਪ 'ਤੇ ਨਹੀਂ ਲਿਖੇ ਜਾਂਦੇ ਬਾਕੀ ਇਹ ਆ ਕਿ ਹਾਂ ਪਿਛਲੇ ਕੁਛ ਸਾਲਾਂ ਤੋਂ ਮੇਰਾ ਲਿਖਣ ਦਾ ਜਿਹੜਾ ਇੱਕ ਤਰੀਕਾ ਉਹ ਜ਼ਰੂਰ ਬਦਲਿਆ ਪਹਿਲਾਂ ਮੈਂ ਜ਼ਿਆਦਾਤਰ ਆਪਣੇ ਬਾਰੇ ਲਿਖਦੀ ਹਾਂ ਮੇਰੇ ਇਮੋਸ਼ਨ ਬਾਰੇ ਲਿਖਦੀ ਹਾਂ ਜਾਂ ਮੇਰੇ ਦਿਨ ਵਿੱਚ ਕੀ ਕੀ ਮੈਂ ਕੀਤਾ ਇੱਕ ਡਾਇਰੀ 'ਚ ਮਤਲਬ ਇੱਕ ਡਾਇਕੀ ਦੇ ਤੌਰ 'ਤੇ ਲਿਖਦੀ ਸੀਗੀ ਫਿਰ ਹੌਲੀ ਹੌਲੀ ਜਿੱਦਾਂ ਜਿੱਦਾਂ ਫਿਰ ਮੈਂ ਕੁਛ ਨੋਵਲਸ ਪੜ੍ਹੇ ਕੁਛ ਬੁੱਕਸ ਪੜ੍ਹੀਆਂ ਕਿ ਉਹਦੇ ਵਿੱਚ ਫਿਰ ਮੈਂ ਇਹ ਹੀ ਚੀਜ਼ਾਂ ਦੇਖੀਆਂ ਜਿੱਦਾਂ ਰਾਈਟਰ ਆ ਜਿਹੜੇ ਲਿਖ ਲਿਖਤ ਲਿ ਲਿਖਾਰੀ ਹੁੰਦੇ ਨੇ ਉਹ ਜ਼ਿਆਦਾਤਰ ਜਿਹੜੇ ਇਨਵਾਇਰਮੈਂਟ ਦੀਆਂ ਸੋਸ਼ਲ ਸਮਾਜਿਕ ਮੁੱਦੇ ਆ ਉਹਦੇ 'ਤੇ ਲਿਖਦੇ ਆ ਅਤੇ ਫਿਰ ਇੱਕ ਮੇਰੀ ਸ਼ੁਰੂ ਤੋਂ ਇਹ ਚੀਜ਼ ਰਹੀ ਆ ਕਿ ਜਿੱਦਾਂ ਜੋ ਮੈਂ ਲਿਖਾਂ ਉਹ ਲੋਕ ਦੇਖਣ ਪੜ੍ਹਨ ਜਾਂ ਫਿਰ ਜਿੱਦਾਂ ਇੱਕ ਸਟੋਰੀ ਲਿਖਾਂ ਜਿਹੜੀ ਮੇਰੀ ਐਜ ਅ ਮੂਵੀ ਦੇ ਥਰੂ ਜਾਂ ਥੀਏਟਰ ਦੇ ਥਰੂ ਦਿਖਾਈ ਜਾਵੇ ਇਸ ਕਰਕੇ ਫਿਰ ਮੈਂ ਡਾਇਰੀ ਛੱਡ ਕੇ ਜਾਂ ਆਪਣੇ ਬਾਰੇ ਛੱਡ ਕੇ ਫਿਰ ਮੈਂ ਸਮਾਜਿਕ ਮੁੱਦਿਆਂ 'ਤੇ ਲਿਖਣਾ ਸ਼ੁਰੂ ਕਰਤਾ ਇਹ ਹੀ ਬਦਲਾਵ ਹੋਇਆ ਵਾ ਮੇਰੀ ਜ਼ਿਦਗੀ ਵਿੱਚ ਮ ਜਾਂ ਫਿਰ ਮੇਰੇ ਲਿਖਣ ਦੇ ਇੱਕ ਤਰੀਕੇ ਵਿੱਚ ਪਿਛਲੇ ਕੁਛ ਸਾਲਾਂ ਤੋਂ